ਸਾਡੇ ਸੱਭਿਆਚਾਰ ਵਿੱਚ ਮੁੱਖ ਕਿੱਤਾ ਖੇਤੀਬਾੜੀ ਹੈ ਪ੍ਰੰਤੂ ਖੇਤੀਬਾੜੀ ਵਿੱਚ ਲੋਕਾਂ ਨੂੰ ਬਹੁਤ ਹੀ ਘੱਟ ਮੁਨਾਫਾ ਹੈ ਇਸ ਕਰਕੇ ਲੋਕ ਆਪਣੇ ਆਪਣੇ ਕੰਮ ਸ਼ੁਰੂ ਕਰ ਗਏ ਹਨ ਕੋਈ ਬਾਹਰ ਚੱਲ ਗਿਆ ਹੈ ਕੋਈ ਆਪਣਾ ਆਪਣਾ ਬਿਜ਼ਨੈਸ ਚਲਾਉਣ ਲੱਗ ਗਿਆ ਅਤੇ ਫਿਰ ਫੈਕਟਰੀਆਂ ਵਿੱਚ ਲੱਗ ਗਏ ਅਤੇ ਪ੍ਰਾਈਵੇਟ ਨੌਕਰੀਆਂ ਕਰਨ ਲੱਗ ਗਏ ਹਨ